ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਮੈਮ ਕੀ ਪੁੱਛਣਾ ਮੈਮ ਸੀਗਾ ਇੱਕ ਨਾ ਜਿਹੜੀ ਬ੍ਰਿਟਿਸ਼ ਸਰਕਾਰ ਸੀ ਇੱਥੇ ਬਰਤਾਨੀਆ ਹਕੂਮਤ ਸੀ ਉਸ ਹਕੂਮਤ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਜਿਹਨੂੰ ਆਪਾਂ ਰੋਲਟ ਐਕਟ ਦੇ ਨਾਲ ਜਾਣਦੇ ਆ ਉਸ ਰੋਲਟ ਐਕਟ ਕਿ ਉਹ ਕਿਸੇ ਵੀ ਹਿੰਦੁਸਤਾਨੀ ਨੂੰ ਅਰੈਸਟ ਕਰਕੇ ਹਵਾਲਾਤ ਦੇ ਵਿੱਚ ਬੰਦ ਕਰ ਸਕਦੇ ਸੀ ਜਿੰਨੀ ਦੇਰ ਉਹ ਚਾਹੁਣ ਐਮਰਜੰਸੀ ਦਾ ਨਾਮ ਦੇ ਕੇ ਜਿੰਨੀ ਦੇਰ ਮਰਜ਼ੀ ਉਹਨਾਂ ਨੂੰ ਬੰਦ ਕਰ ਸਕਦੇ ਸੀ ਇਸ ਚੀਜ਼ ਦੇ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਜਿਹੜੇ ਆ ਲੋਕੀ ਉੱਥੇ ਵਿਸਾਖੀ ਵਾਲੇ ਦਿਨ ਇਕੱਠੇ ਹੋਏ ਸੀ ਤਰੀਕ ਸੀਗੀ ਅਠਾਰਾਂ ਮਾਰਚ ਉੱਨੀ ਸੌ ਉੱਨੀ ਨੂੰ ਐਕਟ ਪਾਸ ਹੋਇਆ ਸੀ ਅਤੇ ਤੇਰ੍ਹਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਇਹ ਲੋਕ ਜਿਹੜੇ ਨੇ ਇਸ ਚੀਜ਼ ਦੇ ਅਗੇਂਸਟ ਪ੍ਰੋਟੈਸਟ ਕਰਨ ਵਾਸਤੇ ਜਲਿਆਂ ਵਾਲਾ ਬਾਗ਼ ਬਾਗ਼ ਦੇ ਵਿੱਚ ਇਕੱਠੇ ਹੋਏ ਸੀ ਨਹੀਂ ਇਹ ਇਹ ਸਿਰਫ ਇਸ ਅੰਮ੍ਰਿਤਸਰ ਦੇ ਦੋ ਜਿਹੜੇ ਨੇ ਨਾ ਉਹ ਐਕਟੀਵਿਸਟ ਨੇ ਜਿਨ੍ਹਾਂ ਦਾ ਨਾਮ ਹਿਸਟਰੀ 'ਚ ਵੱਜਦਾ ਇੱਕ ਸੀਗੇ ਸੈਫੁਦੀਨ ਕਿਚਲੂ ਅਤੇ ਇੱਕ ਸੱਤਿਆਪਾਲ ਜੀ ਇਹ ਦੋਨਾਂ ਨੂੰ ਇਸੇ ਕਾਨੂੰਨ ਦੇ ਤਹਿਤ ਉਹਨਾਂ ਨੇ ਜਿਹੜਾ ਹਵਾਲਾਤ 'ਚ ਬੰਦ ਕਰ ਦਿੱਤਾ ਸੀ ਅਤੇ ਇਹ ਇਸੇ ਚੀਜ਼ ਦੇ ਅਗੇਂਨਸਟ ਜਾ ਕੇ ਲੋਕੀ ਇਕੱਠੇ ਹੋਏ ਸੀ ਹਾਂਜੀ ਰੋਲਰ ਐਕਟ ਦੇ ਅਗੇਂਨਸਟ ਬੋਲਣਾ ਅਤੇ ਜਿਹੜੇ ਦੋ ਜਣੇ ਅਰੈਸਟ ਕੀਤੇ ਸੀ ਇਹਨਾਂ ਨੂੰ ਹਵਾਲਾਤ ਤੋਂ ਬਰੀ ਕਰਾਉਣਾ ਇਹ ਸੂਤ ਦੇ ਅਤੇ ਮੈਮ ਉਸ ਵੇਲੇ ਨਾ ਉਸ ਏਰੀਏ ਦਾ ਇੰਚਾਰਜ ਸੀਗਾ ਬ੍ਰਿਗੇਡੀਅਰ ਜਨਰਲ ਆਰ ਐੱਚ ਡਾਇਰ ਜਨਰਲ ਡਾਇਰ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕੁਝ ਲੋਕ ਜਿਹੜੇ ਨੇ ਉਹ ਸਾਡੇ ਕਾਨੂੰਨ ਦੇ ਖਿਲਾਫ਼ ਇਕੱਠੇ ਹੋਏ ਨੇ ਅਤੇ ਉਹ ਉਸ ਵੇਲੇ ਚੀਜ਼ ਬੜੀ ਨਾਗਵਾਰ ਗੁਜਰੀ ਸੀ ਅਤੇ ਉਸਨੇ ਕਿਉਂਕਿ ਜਲਿਆਂ ਬਾਗ਼ ਵਾਲਾ ਬਾਗ਼ ਤੁਸੀਂ ਹੁਣ ਦੇਖ ਕੇ ਆਏ ਹੋ ਇੱਕ ਭੀੜੀ ਜਿਹੀ ਗਲੀ ਹੈ ਗਲੀ ਦੇ ਵਿੱਚੋਂ ਦੀ ਜਾ ਕੇ ਰਸਤਾ ਉਹਦਾ ਬਹੁਤਾ ਇੱਧਰ ਉੱਧਰ ਭੱਜਣ ਦੀ ਜਗਾ ਉਹਨੇ ਉੱਥੇ ਹੀ ਜਾ ਕੇ ਉਹ ਰਸਤਾ ਜਿਹੜਾ ਨਾ ਉਹ ਬਲੋਕ ਕਰ ਦਿੱਤਾ ਅਤੇ ਆਪਣੀ ਪੂਰੀ ਪਲਟਨ ਲੈ ਕੇ ਗਿਆ ਸੀ ਜਿੰਨੇ ਵੀ ਲੋਕ ਉਥੇ ਇਕੱਠੇ ਹੋਏ ਸੀ ਜਾਰਿਹਾਂ ਸਾਰਿਆਂ ਦੇ ਉੱਪਰ ਇਹਨਾਂ ਧੁੰਦ ਫਾਇਰਿੰਗ ਜਿਹੜੀ ਉਹਨੇ ਕਰ ਦਿੱਤੀ ਸੀਗੀ ਉਹਦਾ ਮੇਨ ਮੰਤਵ ਸੀਗਾ ਵੀ ਇੱਥੋਂ ਕੁਛ ਬਚ ਕੇ ਜਾਣਾ ਨਹੀਂ ਚਾਹੀਦਾ ਬਸ ਹੋਰ ਉਹਦਾ ਕੋਈ ਮੰਤਵ ਨਹੀਂ ਮੈਮ ਖੂਹ ਜਿਹੜਾ ਨਾ ਉਹ ਮਸ਼ਹੂਰ ਹੀ ਇਸ ਕਰਕੇ ਹੋਇਆ ਸੀ ਜਦੋਂ ਰਸਤਾ ਬਾਹਰ ਆਉਂਦਾ ਰਸਤਾ ਨੇ ਬਲੋਕ ਕਰ ਦਿੱਤਾ ਅਤੇ ਅੰਧਾਧੁੰਦ ਫਾਈਰਿੰਗ ਸ਼ੁਰੂ ਹੋ ਗਈ ਅਤੇ ਕੋਈ ਵੀ ਵਿਚਾਰਾ ਆਪਣੀ ਜਾਨ ਬਚਾਉਣ ਵਾਸਤੇ ਦੌੜੇ ਕੁਝ ਕੰਧਾ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਟੱਪ ਆਏ ਅ ਬੜੇ ਸਾਰੇ ਲੋਕਾਂ ਨੇ ਉੱਥੇ ਜਿਹੜੇ ਸੀਗੇ ਉਹ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਮਾਰੀ ਤਾਂ ਉਨ੍ਹਾਂ ਨੇ ਇਸ ਕਰਕੇ ਜਿਹਦੇ ਸ਼ਾਇਦ ਗੋਲੀ ਤੋਂ ਬਚਾ ਹੋ ਜਾਏਗਾ ਪਰ ਫਿਰ ਖੂਹ ਦੇ ਵਿੱਚ ਡੁੱਬ ਕੇ ਇੱਕ ਦੂਜੇ ਦੇ ਉੱਪਰ ਦਬਾਅ ਪੈ ਕੇ ਉਹਨਾਂ ਦੇ ਉਥੇ ਹੀ ਉਹਨਾਂ ਨੇ ਗਮ ਤੋੜ ਦਿੱਤਾ ਉਸ ਖੂਹ ਦਾ ਇਤਿਹਾਸ ਇਸ ਸਾਕੇ ਦੇ ਨਾਲ ਤਾਂ ਕਰਕੇ ਜੁੜਿਆ ਮੈਮ ਉਸ ਵੇਲੇ ਇਹ ਸੀਗਾ ਕਿ ਉਹ ਸੀਗੇ ਤਸ਼ੱਦਦ ਕਰਨ ਵਾਲੇ ਉਹਨਾਂ ਨੂੰ ਇਹ ਸੀਗਾ ਕਿ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਬਰਤਾਨੀਆ ਹਕੂਮਤ ਹੈ ਨਾ ਉਹਦਾ ਦਬਦਬਾ ਕਾਇਮ ਕਰਕੇ ਰੱਖਣਾ ਔਰ ਦਬਦਬਾ ਕਾਇਮ ਕਰਨ ਵਾਸਤੇ ਉਹਨਾਂ ਨੂੰ ਬਰਤਾਨੀ ਸਰਕਾਰ ਦੀ ਪੂਰੀ ਜਿਹੜੀ ਸੀ ਉਹ ਸ਼ਹਿ ਸੀਗੀ ਕੋਈ ਵੀ ਉਹਨਾਂ ਦੇ ਖਿਲਾਫ਼ ਕੋਈ ਕੇਸ ਨਹੀਂ ਸੀ ਚੱਲਦਾ ਕੋਈ ਕੁਛ ਨਹੀਂ ਸੀ ਹੁੰਦਾ ਕੋਈ ਇਨਵੈਸਟੀਗੇਸ਼ਨ ਤੱਕ ਉਹਨਾਂ ਦੇ ਖਿਲਾਫ਼ ਨਹੀਂ ਸੀ ਕੀਤੀ ਜਾਂਦੀ ਅਤੇ ਜਦੋਂ ਇੰਨਾ ਵੱਡਾ ਸਾਕਾ ਹੋ ਗਿਆ ਹੋਏ ਵੀ ਸੌਂਆਂ ਦੀ ਗਿਣਤੀ ਦੇ ਵਿੱਚ ਜਾਨਾਂ ਗਈਆਂ ਹੋਣ ਅਤੇ ਆਮ ਪਬਲਿਕ ਦੇ ਵਿੱਚ ਫਿਰ ਇਹਨਾਂ ਦਮ ਹੀ ਨਹੀਂ ਰਹਿ ਜਾਂਦਾ ਕਿ ਮੌਕੇ 'ਤੇ ਕੁਝ ਕਰ ਲੈਣ ਨੋ ਡਾਊਟ ਇਹਦਾ ਬਾਅਦ ਦੇ ਵਿੱਚ ਬਦਲਾ ਲਿਆ ਜਨਰਲ ਡਾਇਰ ਨੂੰ ਮਾਰ ਕੇ ਬਦਲਾ ਲਿਆ ਗਿਆ ਲੇਕਿਨ ਉਸ ਮੌਕੇ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਉਸ ਜਗ੍ਹਾ ਲੋਕੇਸ਼ਨ ਆ ਉਹ ਮੈਡਮ ਉਹ ਵਾਲੇ ਜਿਹੜਾ ਬਹੁਤ ਸਾਲ ਬਾਅਦ ਦੀ ਗੱਲ ਹੈ ਊਧਮ ਸਿੰਘ ਨੇ ਜਿਹੜਾ ਉਹਦਾ ਬਦਲਾ ਲਿਆ ਉਸ ਮੌਕੇ ਦੇ ਉੱਪਰ ਜਿਹੜਾ ਨਾ ਉਸ ਮੌਕੇ ਦੇ ਉੱਪਰ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਸੀ ਹੋ ਸਕਦਾ ਮੈਮ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਸੀ ਨਾ ਕਿ ਰਸਤਾ ਬੜਾ ਛੋਟਾ ਜਿਹਾ ਛੋਟੀ ਜਿਹੀ ਗਲੀ ਆ ਉੱਥੋਂ ਅੰਦਰ ਜਾਣਾ ਅਤੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਆ ਇਸ ਕਰਕੇ ਉੱਥੇ ਕਿਸੇ ਦੀ ਹੈਲਪ ਹੋਣਾ ਜਿਹੜਾ ਉਹ ਮੁਨਾਸਬ ਹੀ ਨਹੀਂ ਸੀ